ਪਟਿਆਲਾ ਬਹੁਤ ਹੀ ਵਧੀਆ ਸ਼ਹਿਰ ਹੈ ਇੱਥੇ ਬਹੁਤ ਸਾਰੇ ਕਾਰੋਬਾਰ ਹਨ ਜਿਵੇਂ ਜੁੱਤੀਆਂ ਦਾ ਹੋ ਗਿਆ ਕੱਪੜੇ ਦਾ ਹੋ ਗਿਆ ਪਰਾਂਦੀਆਂ ਦਾ ਹੋ ਗਿਆ ਪਟਿਆਲੇ ਵਿੱਚ ਇੱਕ ਨਹੀਂ ਬਹੁਤ ਸਾਰੇ ਸਥਾਨਕ ਜੋ ਕਾਰੋਬਾਰ ਨੇ ਜਿਹੜੇ ਕਿ ਬਹੁਤ ਜ਼ਿਆਦਾ ਫੇਮਸ ਨੇ ਜ਼ਿਆਦਾਤਰ ਪਟਿਆਲੇ 'ਚ ਲੋਕ ਵਿਜਿਟ ਕਰਦੇ ਨੇ ਕਿ ਇੱਥੇ ਜਾ ਕੇ ਅਸੀਂ ਪੰਜਾਬੀ ਜੁੱਤੀਆਂ ਖਰੀਦੀਏ ਪਰਾਂਦੇ ਖਰੀਦੀਏ ਅਤੇ ਸੂਟ ਤਾਂ ਪਟਿਆਲੇ ਦੇ ਬਹੁਤ ਹੀ ਵਧੀਆ ਅੱਜ ਕੱਲ੍ਹ ਮਿਲਣ ਲੱਗ ਗਏ ਹਨ ਪਹਿਲਾਂ ਇਹ ਹੁੰਦਾ ਸੀ ਕਿ ਉਹ ਜਿਹੜਾ ਕੱਪੜਾ ਸੀ ਉਹ ਇੰਨਾ ਜ਼ਿਆਦਾ ਅੱਛਾ ਨਹੀਂ ਮਿਲਦਾ ਸੀ ਪਟਿਆ ਕਿ ਹਰ ਜਗ੍ਹਾ ਦੇ ਉੱਤੇ ਪਟਿਆਲਾ ਛੱਡੋ ਹਰ ਜਗ੍ਹਾ 'ਤੇ ਲਗਾ ਲਉ ਪਰ ਪਟਿਆਲਾ 'ਚ ਕੁਛ ਲੋਕ ਦੂਰ ਦੂਰ ਤੋਂ ਆਉਂਦੇ ਨੇ ਕਿ ਕੱਪੜਾ ਪਟਿਆਲੇ 'ਚ ਬਹੁਤ ਵਧੀਆ ਆ ਜੁੱਤੀਆਂ ਪਟਿਆਲੇ ਦੀਆਂ ਬਹੁਤ ਵਧੀਆਂ ਨੇ ਜੋ ਜੁੱਤੀਆਂ ਪਟਿਆਲੇ 'ਚ ਮਿਲਦੀਆਂ ਨੇ ਸ਼ਾਇਦ ਉਹ ਕਿਤੇ ਵੀ ਨਹੀਂ ਮਿਲਦੀਆਂ ਪਟਿਆਲੇ ਦੇ ਪਰਾਂਦੇ ਵੀ ਬਹੁਤ ਹੀ ਮਸ਼ਹੂਰ ਨੇ ਅਤੇ ਪਹਿਲਾਂ ਕੀ ਸੀ ਕਿ ਇਹ ਚੀਜ਼ਾਂ ਨਹੀਂ ਸੀ ਕਿ ਜੋ ਅੱਜ ਦੇ ਜ਼ਮਾਨੇ 'ਚ ਹੁਣ ਮਿਲ ਰਹੀਆਂ ਨੇ ਪਟਿਆਲੇ 'ਚ ਪਹਿਲਾਂ ਬਹੁਤ ਓਲਡ ਫੈਸ਼ਨ ਸੀ ਅੱਜ ਕੱਲ੍ਹ ਟਰੈਂਡ ਨੇ ਨਾਲ ਜਿੱਦਾਂ ਜਿੱਦਾਂ ਟਰੈਂਡ ਆਉਂਦਾ ਉੱਦਾਂ ਦਾ ਹੀ ਪਟਿਆਲੇ ਦੇ ਵਿੱਚ ਹਰ ਚੀਜ਼ ਮਿਲਣ ਲੱਗ ਗਈ ਇਕੋਨਮੀ ਨੂੰ ਵੀ ਸਾਡੇ ਨੂੰ ਬਹੁਤ ਜ਼ਿਆਦਾ ਬੈਨੀਫਿਟ ਦੇ ਰਹੀ ਹੈ ਕਿਉਂਕਿ ਅੱਜ ਕੱਲ੍ਹ ਪਟਿਆਲੇ ਦੇ ਵਿੱਚ ਤਾਂ ਲੋਕ ਨੇ ਜੋ ਕਾਰੀਗਰਸ ਬਹੁਤ ਨੇ ਇੱਕ ਤਾਂ ਇੱਥੇ